ਹੈਲੋ ਸਰ ਓਲਾ ਟੈਕਸੀ ਕੈਬ ਹਾਂਜੀ ਸਰ ਮੇਰਾ ਨਾਮ ਪਰਮਿੰਦਰ ਹੈ ਸਰ ਮੈਂ ਤਰਤਾਲ਼ੀ ਸੈਕਟਰ ਤੋਂ ਬੋਲ ਰਿਹਾ ਅਤੇ ਮੇਰੀ ਮੀਟਿੰਗ ਹੈ ਬਿਜਨਸ ਮੀਟਿੰਗ ਹੈ ਗੋਆ ਅਤੇ ਮੇਰੀ ਫਲਾਈਟ ਬੁੱਕ ਹੈ ਚੰਡੀਗੜ੍ਹ ਟੂ ਗੋਆ ਐਂਡ ਮੇਰੀ ਫਲਾਈਟ ਹੈ ਨੂਨ ਦੀ ਫਲਾਈਟ ਹੈ ਮੈਨੂੰ ਅਤੇ ਮੈਨੂੰ ਟੈਕਸੀ ਮੈਂ ਬੁੱਕ ਕਰਵਾਉਣੀ ਸੀ ਹਾਂਜੀ ਮੈਂ ਇਕੱਲਾ ਹੀ ਹੈ ਜੀ ਸਿੰਗਲ ਹੀ ਹੈ ਅਤੇ ਮੇਰੇ ਨਾਲ ਬਸ ਇੱਕ ਹੈਂਡਬੈਗ ਹੈ ਅਤੇ ਇੱਕ ਮੇਰਾ ਹੈਂਡਬੈਗ ਐਂਡ ਲਗੇਜ਼ ਹੈ ਅਤੇ ਅਗਰ ਤੁਸੀਂ ਮੈਨੂੰ ਦਸ ਵਜੇ ਗ ਪ੍ਰੋਵਾਈਡ ਕਰਾ ਦਿਉ ਤਾਂ ਇਟਸ ਕੰਫਰਟੇਬਲ ਫੋਰ ਮੀ ਕਿਉਂਕਿ ਹਾਰਡਲੀ ਇੱਕ ਘੰਟੇ ਦਾ ਰਸਤਾ ਹੈ ਮੇਰੇ ਘਰ ਤੋਂ ਏਅਰਪੋਰਟ ਦਾ ਅਤੇ ਮਾਈਟ ਬੀ ਦੇਅਰ ਟਰੈਫਿਕ ਹੋਵੇ ਸੋ ਅਸੀਂ ਸੋਚਦੇ ਹਾਂ ਵੀ ਪਹਿਲਾ ਨਿਕਲ ਜਾਈਏ ਅਗਰ ਕੋਈ ਟਰੈਫਿਕ ਹੋਵੇ ਤਾਂ ਅੱਛਾ ਰਹੇਗਾ ਵੀ ਅਸੀਂ ਟਾਈਮ ਸਿਰ ਪਹੁੰਚ ਜੀਏ ਅਤੇ ਤੁਸੀਂ ਮੈਨੂੰ ਪਲੀਜ਼ ਚਾਰਜ਼ ਦੱਸ ਦਿਉ ਕਿੰਨੇ ਹੈ ਅਤੇ ਮੈਂ ਏ ਸੀ ਵਾਲੀ ਬੁੱਕ ਕਰਨਾ ਚਾਹੁੰਦਾ ਕੈਬ ਅਤੇ ਉਹ ਮੈਨੂੰ ਜਲਦੀ ਜਲਦੀ ਤੋਂ ਜਲਦੀ ਕੰਟੈਕਟ ਕਰ ਲਉ ਅਗਰ ਤੁਸੀਂ ਨਹੀਂ ਜਾ ਸਕਦੇ ਤਾਂ ਮੈਨੂੰ ਤਾਂ ਵੀ ਦੱਸ ਦਿਉ ਕਿਉਂਕਿ ਮੈਂ ਹੋਰ ਮੈਨੇਜ ਕਰ ਲਵਾਂ ਅਗਰ ਤੁਸੀਂ ਨਹੀਂ ਜਾ ਸਕਦੇ ਤਾਂ ਮੈਂ ਕੋਈ ਹੋਰ ਟੈਕਸੀ ਮੈਰੇਜ ਕਰ ਲਵਾਂ ਕਿਉਂਕਿ ਓਫਿਸ਼ਅਲ ਮੀਟਿੰਗ ਹੈ ਮੈਂ ਮਿਸ ਨਹੀਂ ਕਰ ਸਕਦਾ ਇਹ ਮੀਟਿੰਗ ਇਹ ਮੇਰੇ ਲਈ ਬਹੁਤ ਜ਼ਰੂਰੀ ਹੈ ਮੇਰੇ ਕਰੀਅਰ ਲਈ ਮੇਰੇ ਫਿਊਚਰ ਲਈ ਅਤੇ ਪਲੀਜ਼ ਮੈਨੂੰ ਇਨਫੋਰਮ ਕਰਕੇ ਦੱਸੋ ਅਗਰ ਤੁਸੀਂ ਹੋ ਤਾਂ ਮੈਂ ਤੁਹਾਡੀ ਵੇਟ ਕਰਾਂ ਅਤੇ ਮੈਨੂੰ ਜਲਦੀ ਦੱਸੋ ਥੈਂਕਸ ਅੇ ਲੋਟ